ਫੋਟੋਗ੍ਰਾਫ਼ੀ ਵੀ ਇੱਕ ਕਲਾ ਹੈ ਕੁਝ ਲੋਕਾਂ ਨੂੰ ਫੋਟੋਗ੍ਰਾਫ਼ੀ ਦਾ ਸ਼ੌਕ ਹੁੰਦਾ ਹੈ ਅਤੇ ਕੁਝ ਲੋਕਾਂ ਨੇ ਇਸਨੂੰ ਇੱਕ ਕਿੱਤੇ ਵਜੋਂ ਵੀ ਲਿਆ ਹੋਇਆ ਹੈ ਅੱਜ ਕੱਲ ਤਾਂ ਕੈਮਰੇ ਐਨੇ ਵਧੀਆ ਹਨ ਕਿ ਫੋਟੋ ਵਿੱਚ ਬੰਦਾ ਆਪਣੀ ਅਸਲੀ ਸੂਰਤ ਨਾਲੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੈ ਮੈਨੂੰ ਫੋਟੋਗ੍ਰਾਫ਼ੀ ਦਾ ਸ਼ੌਕ ਸੀ ਅਤੇ ਮੈਂ ਇਸਨੂੰ ਇੱਕ ਕਿੱਤੇ ਵਜੋਂ ਲੈਣ ਬਾਰੇ ਸੋਚਿਆ ਸੀ ਪਰ ਕਿਸੇ ਮੁਸ਼ਕਲ ਕਰਕੇ ਨਹੀਂ ਲੈ ਪਾਇਆ ਅੱਜ ਦੀ ਵਿਆਹਾਂ ਸ਼ਾਦੀਆਂ 'ਤੇ ਫੋਟੋਗ੍ਰਾਫ਼ੀ ਕਮਾਲ ਦੀ ਹੈ ਇੱਕ ਵਿਆਹ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਲੜਕੇ ਅਤੇ ਵਿਆਹ ਵਾਲਾ ਲੜਕਾ ਲੜਕੀ ਅਤੇ ਵਿਆਹ ਵਾਲਾ ਲੜਕਾ ਪੂਰਾ ਵਿਆਹ ਵਾਲਾ ਦਿਨ ਜਿਵੇਂ ਉਹਨਾਂ ਦੇ ਹੁਕਮ ਦੀ ਪਾਲਣਾ ਕਰ ਰਹੇ ਹੁੰਦੇ ਹਨ ਸਾਰਾ ਕੁਝ ਫੋਟੋਗ੍ਰਾਫ਼ਰ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਜਿਵੇਂ ਕਿੱਥੇ ਰੁਕਣਾ ਕਿੱਥੇ ਚੱਲਣਾ ਪੋਜ ਬਣਾਉਣੇ ਕਦੀ ਕੁਛ ਕਦੀ ਕੁਛ ਸਾਰਾ ਕੁਛ ਤਾਂ ਫੋਟੋਗ੍ਰਾਫ਼ਰ ਦੇ ਕਹਿਣ ਅਨੁਸਾਰ ਹੀ ਹੁੰਦਾ ਹੈ ਪੂਰੇ ਵਿਆਹ ਵਿੱਚ ਜਿਵੇਂ ਉਹ ਦੱਸੀ ਜਾਂਦੇ ਹਨ ਉਵੇਂ ਹੀ ਉਹ ਕਰੀ ਜਾਂਦੇ ਹਨ ਅੱਜ ਕੱਲ ਤਾਂ ਇੱਕ ਹੋਰ ਨਵਾਂ ਹੀ ਟਰੈਂਡ ਚੱਲ ਚੁੱਕਾ ਹੈ ਜਿਸਨੂੰ ਆਪਾਂ ਪਰੀ ਵੈਡਿੰਗ ਦਾ ਨਾਮ ਦਿੱਤਾ ਹੈ ਪਰੀ ਵੈਡਿੰਗ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਲੋਕ ਜਿਸ ਤਰ੍ਹਾਂ ਮੰਨ ਲਉ ਚੰਡੀਗੜ੍ਹ ਜਾ ਕੇ ਜਾਂ ਹਿਮਾਚਲ 'ਚ ਜਾਂ ਕਿਤੇ ਹੋਰ ਜਾ ਕੇ ਆਪਣਾ ਵਿਆਹ ਤੋਂ ਪਹਿਲਾਂ ਜਿਸ ਤਰ੍ਹਾਂ ਫ਼ਿਲਮ ਬਣਦੀ ਹੈ ਉਸ ਤਰ੍ਹਾਂ ਹੀ ਉਸ ਨੂੰ ਬਣਾ ਕੇ ਅੱਗੇ ਪੇਸ਼ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕੋਈ ਗਾਣਿਆਂ ਦੀ ਤਰਜ਼ 'ਤੇ ਸ਼ੂਟ ਸ਼ੂਟਿੰਗ ਕਰਕੇ ਉਸਨੂੰ ਇੱਕ ਫ਼ਿਲਮ ਹੀ ਬਣਾ ਦਿੱਤਾ ਜਾਂਦਾ ਹੈ ਔਰ ਬਾਅਦ ਵਿੱਚ ਇਹ ਫ਼ਿਲਮ ਮ ਮੈਰਿਜ ਪੈਲਸਾਂ ਵਿੱਚ ਦਿਖਾਉਂਦੇ ਹਨ ਅਤੇ ਫ਼ੋਟੋਆਂ ਵੱਡੀਆਂ ਵੱਡੀਆਂ ਕਰਕੇ ਉਹ ਦਿਖਾਉਂਦੇ ਹਨ ਉਹ ਇਹ ਸਾਰਾ ਕੁਛ ਫੋਟੋਗ੍ਰਾਫ਼ਰ ਹੀ ਕਰਦਾ ਹੈ